ਪੰਜਾਬ ਵਿੱਚ ਟੈਕਨੋਲੋਜੀ ਸੈਕਟਰ ਸਥਾਨਕ ਭਾਈਚਾਰੇ ਜਾਂ ਸਮਾਜ ਨਾਲ ਬਹੁਤ ਤਰੀਕਿਆਂ ਨਾਲ ਜੁੜਿਆ ਹੋਇਆ ਜਿਵੇਂ ਕਿ ਆਪਾਂ ਕਈ ਟੈਕਨੋਲਜੀ ਆਪਣੇ ਆਲੇ ਦੁਆਲੇ ਵੀ ਦੇਖਦੇ ਹਾਂ ਜਿਵੇਂ ਕਿ ਆਪਾਂ ਇੱਕ ਦੂਜੇ ਨਾਲ ਗੱਲਬਾਤ ਕਰਨ ਵਾਸਤੇ ਆਪਣੇ ਯਾਰਾਂ ਦੋਸਤਾਂ ਨਾਲ ਗੱਲ ਕਰਨ ਵਾਸਤੇ ਸਮਾਰਟ ਫੋਨ ਦੀ ਵਰਤੋਂ ਕਰਦੇ ਹਾਂ ਇੱਦਾਂ ਹੀ ਆਪਾਂ ਆਪਣੇ ਦਫਤਰੀ ਕੰਮਾਂ ਕਾਰਾਂ ਲਈ ਕੰਪਿਊਟਰ ਜਾਂ ਬਥੇ ਵਧੇਰੇ ਹੋਰ ਟੈਕਨੋਲੋਜੀ ਨਾਲ ਜੁੜੇ ਸਾਧਨਾਂ ਦੀ ਵਰਤੋਂ ਕਰਦੇ ਹਾਂ ਇਵੇਂ ਹੀ ਸਾਡੇ ਕੋਲ ਹੋਰ ਵੀ ਕਈ ਤਰ੍ਹਾਂ ਦੀ ਚੀਜ਼ਾਂ ਹਨ ਜੋ ਕਿ ਟੈਕਨੋਲੋਜੀ ਨਾਲ ਜੁੜੀਆਂ ਹੋਈਆਂ ਜਿਵੇਂ ਕਿ ਅੱਜ ਕੱਲ੍ਹ ਤਾਂ ਕਿਤਾਬਾਂ ਵੀ ਟੈਕਨੋਲੋਜੀ ਨਾਲ ਆ ਚੁੱਕੀਆਂ ਹਨ ਜਿਵੇਂ ਕਿ ਈ ਬੁੱਕਸ ਆ ਚੁੱਕੀਆਂ ਹਨ ਜਿਵੇਂ ਕਿ ਸਰ ਇਹਦੇ ਕਰਕੇ ਸਾਨੂੰ ਕਿਤਾਬਾਂ ਖਰੀਦਣ ਦੀ ਵੀ ਲੋੜ ਨਹੀਂ ਪੈਂਦੀ ਆਪਾਂ ਆਨਲਾਈਨ ਹੀ ਜਾ ਕੇ ਆਪਣੀ ਕਿਤਾਬਾਂ ਡਾਊਨਲੋਡ ਕਰਕੇ ਉਹਨਾਂ ਨੂੰ ਪੜ੍ਹ ਸਕਦੇ ਹਾਂ ਅਤੇ ਹੋਰ ਕੋਈ ਕੰਮ ਕਰ ਸਕਦੇ ਹਾਂ ਜਿਵੇਂ ਕਿ ਅੱਜ ਕੱਲ੍ਹ ਵੀਡੀਓ ਕਾਲ ਰਾਹੀਂ ਵੀ ਆਪਾਂ ਆਪਣੇ ਯਾਰਾਂ ਦੋਸਤਾਂ ਨਾਲ ਗੱਲਬਾਤ ਕਰ ਸਕਦੇ ਹਾਂ ਨਾਲੇ ਆਪਣੇ ਪਰਿਵਾਰ ਦੇ ਜਿਹੜੇ ਕਿ ਵੀ ਸਦੱਸਿਆ ਆਪਣਿਆਂ ਤੋਂ ਬ ਆਪਣਿਆਂ ਤੋਂ ਬਹੁਤ ਦੂਰ ਬੈਠੇ ਆ ਭਾਵੇਂ ਉਹ ਵਿਦੇਸ਼ ਵਿੱਚ ਵੀ ਹੋਣ ਆਪਾਂ ਉਹਨਾਂ ਨਾਲ ਬਹੁਤ ਹੀ ਆਸਾਨੀਅਤ ਨਾਲ ਗੱਲਬਾਤ ਕਰ ਸਕਦੇ ਹਾਂ ਇਹ ਸਾਰੇ ਹੀ ਹੀ ਤਰੀ ਸਾਰੇ ਹੀ ਟੈਕਨੋਲੋਜੀ ਨਾਲ ਸੰਭਵ ਹੋ ਸਕਿਆ ਹੈ ਟੈਕਨੋਲੋਜੀ ਦਾ ਸਾਡੇ ਜੀਵਨ ਵਿੱਚ ਅੱਜ ਦੇ ਟਾਈਮ 'ਤੇ ਬਹੁਤ ਹੀ ਜ਼ਿਆਦਾ ਮਹੱਤਵਪੂਰਨ ਹੈ ਕਿਉਂਕਿ ਟੈਕਨੋਲੋਜੀ ਨਾ ਹੋਵੇ ਤਾਂ ਆਪਾਂ ਆਪਣਾ ਬਥੇਰਾ ਕੰਮ ਨਹੀਂ ਕਰ ਪਾਉਂਦੇ ਅੱਜ ਕੱਲ੍ਹ ਤਾਂ ਛੋਟੇ ਤੋਂ ਛੋਟਾ ਕੰਮ ਵੀ ਟੈਕਨੋਲੋਜੀ ਦੁਆਰਾ ਹੀ ਕੀਤਾ ਜਾਂਦਾ ਹੈ ਜਿਵੇਂ ਕਿ ਸਾਡੇ ਆਫਿਸ ਦੇ ਇੱਕ ਛੋਟਾ ਛੋਟਾ ਕੰਮ ਵੀ ਆਪਾਂ ਮੇਲ ਕਰਨੀ ਕਿਸੇ ਨਾਲ ਕੋਈ ਗੱਲਬਾਤ ਕਰਨੀ ਕੋਈ ਮੀਟਿੰਗ ਕਰਨੀ ਸਾਰੇ ਹੀ ਟੈਕਨੋਲੋਜੀ ਦੁਆਰਾ ਹੀ ਕੀਤੀਆਂ ਜਾਂਦੀਆਂ ਹਨ